ਹੈਲੋ ਸਰ ਸਤਿ ਸ਼੍ਰੀ ਅਕਾਲ ਮੈਂ ਤਿੰਨ ਤਰੀਕ ਨੂੰ ਇੱਕ ਕੋਟਨ ਬਲੈਂਡ ਵਾਈਟ ਕਲਰ ਦੀ ਕੁੜਤੀ ਸੀ ਜਿਹੜੀ ਔਡਰ ਲਾਈ ਸੀ ਤੇ ਉਹ ਔਡਰ ਮੈਨੂੰ ਕੱਲ ਹੀ ਮਿਲਿਆ ਤਾਂ ਉਹ ਜਿਹੜਾ ਮੈਂ ਉਸ ਦਾ ਆਕਾਰ ਦੱਸਿਆ ਸੀ ਉਹ ਬੋ ਉਹ ਉਸ ਤੋਂ ਦਰਅਸਲ ਬਹੁਤ ਜਿਆਦਾ ਛੋਟੀ ਆ ਗਈ ਉਹ ਤਾਂ ਆਇਆ ਹੀ ਨਹੀਂ ਜੋ ਮੈਂ ਮੰਗਵਾਇਆ ਸੀਗਾ ਤਾਂ ਇੱਕ ਉਸਦਾ ਜਿਹੜਾ ਸਟੱਫ ਹੈ ਉਹ ਬਹੁਤ ਜਿਆਦੇ ਖਰਾਬ ਹੋਇਆ ਹੋਇਆ ਆਇਆ ਹੈਗਾ ਤਾਂ ਮੈਂ ਉਸਨੂੰ ਰਿਟਰਨ ਕਰਨਾ ਚਾਹੁੰਦੀ ਆਂ ਤੇ ਉਸਦੇ ਬਦਲੇ ਇੱਕ ਨਵੇਂ ਔਡਰ ਕਰਨਾ ਚਾਹੁੰਦੇ ਆ ਤੇ ਤੁਸੀਂ ਮੈਨੂੰ ਉਸ ਬਾਰੇ ਸਾਰਾ ਕੁਛ ਦੱਸ ਦੋ ਕਿ ਮੈਂ ਉਸਨੂੰ ਕਿਸ ਤਰ੍ਹਾਂ ਰਿਟਰਨ ਕਰਾਂ ਐਂਡ ਕਿਸ ਤਰ੍ਹਾਂ ਨਾਲ ਉਸਨੂੰ ਦੁਬਾਰਾ ਰੀ ਔਡਰ ਕਰਾਂ ਤਾਂ ਕੀ ਜਿਹੜੀਆਂ ਤਾਂ ਕੀ ਜਿਹੜੀ ਮੇਰੇ ਕੋਲੇ ਚੰਗੀ ਵੱਡੇ ਆਕਾਰ ਦੀ ਮਤਲਬ ਜਿੰਨਾ ਮੈਨੂੰ ਚਾਹੀਦਾ ਉਵੇਂ ਦੀ ਤੇ ਸਹੀ ਸਟੱਫ ਕੁੜਤੀ ਪ੍ਰਾਪਤ ਹੋ ਸਕੇ ਦਰਅਸਲ ਮੈਂ ਮੈਂ ਔਨਲਾਈਨ ਸ਼ੋਪਿੰਗ ਬਾਰੇ ਹਮੇਸ਼ਾ ਸੁਣਦੀ ਸੀ ਪਰ ਮੈਂ ਕਦੇ ਕੀਤੀ ਨਹੀਂ ਸੀ ਤਾਂ ਫਸਟ ਟਾਈਮ ਕੀਤੀ ਸੀ ਸੋ ਫਸਟ ਟਾਈਮ ਹੀ ਐਵੇਂ ਹੋ ਗਿਆ ਸੋ ਪਲੀਜ਼ ਸਰ ਤੁਸੀਂ ਸ਼ਾਇਦ ਸਮਝ ਰਹੇ ਹੋਗੇ ਮੇਰੀ ਗੱਲ ਨੂੰ ਪਲੀਜ਼ ਮੈਨੂੰ ਛੇਤੀ ਤੋਂ ਛੇਤੀ ਤੇ ਇੱਕ ਸਰਵਿਸ ਬਹੁਤ ਜਿਆਦਾ ਸਲੋਅ ਐ ਤਾਂ ਕਰਕੇ ਤੁਸੀਂ ਥੋੜਾ ਜਿਹਾ ਉਸ ਵੱਲ ਵੀ ਧਿਆਨ ਦੇ ਦਿਓ ਤਾਂ ਕੀ ਉਹ ਮੈਨੂੰ ਛੇਤੀ ਤੋਂ ਛੇਤੀ ਪ੍ਰਾਪਤ ਹੋ ਸਕੇ ਤੇ ਬਹੁਤ ਜਿਆਦਾ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਮੈਂ ਉਸ ਕੁੜਤੀ ਮੈਂ ਉਹ ਕੁੜਤੀ ਦਰਅਸਲ ਇੱਕ ਫੰਕਸ਼ਨ ਵਾਸਤੇ ਮੰਗਵਾਈ ਸੀ ਸਾਡੇ ਇੱਕ ਫੰਕਸ਼ਨ ਸੀ ਮੈਨੂੰ ਐਵੇ ਸੀ ਕਿ ਮੈਂ ਉਹ ਕੁੜਤੀ ਪਾ ਲੂੰਗੀ ਪਰ ਉਹ ਬਹੁਤ ਜਿਆਦਾ ਖਰਾਬ ਆਈ ਤਾਂ ਉਸ ਨੂੰ ਦੇਖ ਕੇ ਮੇਰਾ ਮੈਨੂੰ ਜਮਾਂ ਵੀ ਚੰਗਾ ਨਹੀਂ ਫੀਲ ਹੋਇਆ ਪਲੀ ਸੋ ਜਲਦੀ ਤੋਂ ਜਲਦੀ ਮੈਨੂੰ ਉਹ ਅੱਛੀ ਕੁੜਤੀ ਪ੍ਰਾਪਤ ਹੋ ਸਕੇ ਤਾਂ ਤੁਸੀਂ ਉਸ ਮੇਰੀ ਇਸ ਸ਼ਾਇਦ ਤੁਸੀਂ ਮੇਰੀ ਐਸ ਜਾਣਕਾਰੀ ਬਾਰੇ ਨਾਲ ਤੁਸੀਂ ਮੇਰੀ ਐਸ ਪ੍ਰੋਬਲਮ ਨੂੰ ਸੋਲਵ ਕਰੋਗੇ ਤੇ ਛੇਤੀ ਤੋਂ ਛੇਤੀ ਮੈਨੂੰ ਮੇਰਾ ਪ੍ਰੋਡਕਟ ਆਈ ਹੋਪ ਮਿਲ ਜਾਊਗਾ ਤੇ ਬਹੁਤ ਵਧੀਆ ਮਿਲੂਗਾ ਧੰਨਵਾਦ ਸਰ